ਸਮਾਰਟਫੋਨ ਨੇ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾਇਆ ਹੈ ਹਾਂਜੀ ਸਰ ਸਮਾਰਟਫੋਨ ਨੇ ਜ਼ਿੰਦਗੀ ਨੂੰ ਬਿਹਤਰ ਤਾਂ ਸਰ ਬਣਾਇਆ ਜਿਵੇਂ ਕਿ ਫੋਨ ਦੇ ਨਾਲ ਅਸੀਂ ਆਪਣੇ ਬਿਜਨਸ ਨਾਲ ਕਰ ਸਕਦੇ ਹਾਂ ਹਰੇਕ ਚੀਜ਼ ਫੋਨ ਦੇ ਵਿੱਚ ਸਰ ਦੇਖ ਸਕਦੇ ਹਾਂ ਪਰ ਕਈ ਸਾਡੇ ਵਰਗੇ ਜਾਂ ਹੋਰ ਬੱਚੇ ਇਹਨੂੰ ਗਲਤ ਵੀ ਯੂਜ਼ ਕਰਦੇ ਸਰ ਜੀ ਕਿਉਂਕਿ ਵਿਹਲੇ ਸਮੇਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਸਰ ਕੁਛ ਆਪਣੀ ਜ਼ਿੰਦਗੀ ਵਿੱਚ ਬਣਨਾ ਹੁੰਦਾ ਪਰ ਉਹ ਫੋਨ ਦੇ ਵਿੱਚ ਹੀ ਆਪਣਾ ਜਿਹੜਾ ਸਮਾਂ ਸਾਰਾ ਵੇਸਟ ਕਰ ਦਿੰਦੇ ਆ ਕੋਲ ਚਾਹੇ ਕੁਛ ਹੋਈ ਜਾਵੇ ਪਰ ਉਹ ਬੱਚੇ ਆਪਣਾ ਜਿਹੜਾ ਫੋਨ ਹੈ ਆਪਣਾ ਧਿਆਨ ਫੋਨ ਦੇ ਵਿੱਚ ਹੀ ਰੱਖਦੇ ਨੇ ਜਿਹਦੇ ਕਾਰਨ ਥੋੜ੍ਹੀ ਉਹਨਾਂ ਦੀ ਨਿਗ੍ਹਾ ਵੀ ਘੱਟ ਸਕਦੀ ਹੈ ਜੀ ਪਰ ਜਿਹੜਾ ਵਿਹਲਾ ਸਮਾਂ ਆ ਜਾਂ ਕੁਛ ਕਰਨ ਦਾ ਸਮਾਂ ਹੁੰਦਾ ਜਾਂ ਕਿਉਂਕਿ ਸਾਡੇ ਮਾਂ ਬਾਪ ਵੀ ਸਾਨੂੰ ਕਹਿੰਦੇ ਆ ਵੀ ਭਾਈ ਉੱਠ ਆ ਹੁਣ ਆ ਜਾ ਕੰਮ ਕਰ ਲੈ ਕੋਈ ਖੜ੍ਹ ਜਾ ਬੇਬੇ ਆਹ ਦੋ ਮਿੰਟ ਆਇਆ ਉਹ ਪਰ ਫੋਨ ਨੂੰ ਨਹੀਂ ਸਰ ਛੱਡਦੇ ਫੋਨ ਸਰ ਇਹੋ ਜਿਹਾ ਹੋ ਗਿਆ ਇੱਕ ਜ਼ਰੂਰੀ ਹੋ ਗਿਆ ਫੋਨ ਤੋਂ ਬਗੈਰ ਬੱਚੇ ਸਾਰਦੇ ਨਹੀਂ ਜੀ ਨਾ ਨਾ ਕੋਈ ਵੱਡਾ ਨਾ ਛੋਟਾ ਕੋਈ ਵੀ ਫੋਨ ਤੋਂ ਬਗੈਰ ਸਰ ਇੱਕ ਜ਼ਰੂਰਤ ਹੋ ਗਈ ਫੋਨ ਤੋਂ ਬਿਨਾ ਸਰ ਸਰਦਾ ਨਹੀਂ ਹੈ